ਅਸੀਂ ਵੱਖ ਵੱਖ ਕਿਸਮ ਦੇ ਪੌਦੇ ਅਤੇ ਵੇਲਾਂ ਉਗਾਉਂਦੇ ਹਾਂ ਪੌਦੇ ਉਗਾਉਂਦੇ ਹਾਂ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਜਿਵੇਂ ਕਿ ਮਨੀ ਪਲਾਂਟ ਦਾ ਪੌਦਾ ਗੁਲਾਬ ਦਾ ਪੌਦਾ ਗੈਂਦੇ ਦਾ ਪੌਦਾ ਗੁਲਦਾਉਦੀ ਦਾ ਪੌਦਾ ਸਨਫਲਾਵਰ ਪੁਦੀਨੇ ਦਾ ਪੌਦਾ ਨਿੰਬੂ ਦਾ ਪੌਦਾ ਅਤੇ ਟਮਾਟਰ ਦਾ ਪੌਦਾ ਇਹ ਅਸੀਂ ਪੌਦੇ ਉਗਾਉਂਦੇ ਹਾਂ ਅਤੇ ਕੁਛ ਵੇਲਾਂ ਵੀ ਉਗਾਉਂਦੇ ਆਂ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਜਿਵੇਂ ਕੱਦੂ ਦੀਆਂ ਵੇਲਾਂ ਤੋਰੀ ਦੀਆਂ ਵੇਲਾਂ ਪੇਠੇ ਦੀਆਂ ਵੇਲਾਂ ਤਰਾਂ ਦੀਆਂ ਵੇਲਾਂ ਅੰਗੂਰਾਂ ਦੀਆਂ ਵੇਲਾਂ ਚਿੱਬੜਾਂ ਦੀਆਂ ਵੇਲਾਂ ਖੱਖੜੀ ਦੀਆਂ ਵੇਲਾਂ ਖੀਰੇ ਦੀਆਂ ਵੇਲਾਂ ਇਹ ਅਸੀਂ ਪੌਦੇ ਅਤੇ ਵੇਲਾਂ ਉਗਾਉਂਦੇ ਹਾਂ ਮੈਂ ਆਪਣੇ ਘਰ ਦੇ ਨਾਲ ਇੱਕ ਖਾਲੀ ਜਗ੍ਹਾ ਹੈ ਜਿਸ ਵਿੱਚ ਮੈਂ ਕੁਛ ਪੌਦੇ ਅਤੇ ਵੇਲਾਂ ਉਗਾਈਆਂ ਹੋਈਆਂ ਹਨ ਅਤੇ ਉਨ੍ਹਾਂ ਪੌਦਿਆਂ ਨੂੰ ਮੈਂ ਆਪ ਕੇਅਰ ਕਰਦਾ ਹਾਂ ਉਨ੍ਹਾਂ ਪੌਦੇ ਅਤੇ ਵੇਲਾਂ ਨੂੰ ਸਮੇਂ ਸਿਰ ਉਨ੍ਹਾਂ ਵਿੱਚ ਖਾਦ ਪਾਉਂਦਾ ਹਾਂ ਅਤੇ ਉਨ੍ਹਾਂ ਨੂੰ ਸਮੇਂ ਸਿਰ ਪਾਣੀ ਦਿੰਦਾ ਹਾਂ ਤਾਂ ਜੋ ਮੈਨੂੰ ਉਨ੍ਹਾਂ ਤੋਂ ਫਲ ਪ੍ਰਾਪਤ ਹੋਵੇ ਉਨ੍ਹਾਂ ਦੀ ਅਤੇ ਉਹ ਸਾਨੂੰ ਧੁੱਪ ਤੋਂ ਛਾਂ ਕਰਦੇ ਹਨ ਅਤੇ ਸਾਨੂੰ ਸੁਬਹਾ ਸੁਬਹਾ ਔਕਸੀਜਨ ਦਿੰਦੇ ਹਨ ਫਰੈਸ਼ ਹਵਾ ਸੁਬਹਾ ਸੁਬਹਾ ਮਿਲਦੀ ਹੈ ਅਤੇ ਪੌਦਿਆਂ ਅਤੇ ਦ ਦਰਖਤਾਂ ਨਾਲ ਤਾਪਮਾਨ 'ਚ ਬਹੁਤ ਗਿਰਾਵ ਆਉਂਦਾ ਹੈ ਅਤੇ ਜਿਵੇਂ ਹੁਣ ਮੈਂ ਆਮ ਰੁਟੀਨ ਵਿੱਚ ਜਿਵੇਂ ਪੁਦੀਨੇ ਦੀ ਵਰਤੋਂ ਕਰਦੇ ਹਾਂ ਕਿਉਂਕਿ ਪੁਦੀਨੇ ਦੀ ਤਸੀਰ ਠੰਡੀ ਹੁੰਦੀ ਹੈ